ਜਿਵੇਂ ਕਿ ਮੈਨੂੰ ਡਰਾਇੰਗ ਕਰਨਾ ਬਹੁਤ ਹੀ ਪਸੰਦ ਆ ਪਰ ਮੈਂ ਕੋਈ ਵੀ ਵੱਡੇ ਪੱਧਰ 'ਤੇ ਜਾਂ ਕਹਿ ਲਓ ਹਾਈ ਲੈਵਲ 'ਤੇ ਜਾ ਕੇ ਕੁਝ ਵੀ ਇਹੋ ਜਿਹਾ ਨਹੀਂ ਕੀਤਾ ਸੋ ਉਸ ਬੇਸਿਸ 'ਤੇ ਮੈਨੂੰ ਕੋਈ ਇੱਡੀ ਵੱਡੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਮੈਂ ਆਪਣੀ ਖੁਸ਼ੀ ਲਈ ਘਰ ਹੀ ਬੈਠ ਕੇ ਜਿਹੜਾ ਵਾ ਆਪਣਾ ਥੋੜ੍ਹੀ ਛੋਟੀ ਮੋਟੀ ਜਿਹੜੀ ਡਰੋਇੰਗ ਉਹ ਕਰਦੀ ਰਹਿੰਦੀ ਹਾਂ ਪਰ ਮੈਨੂੰ ਡਰੋਇੰਗ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਅਤੇ ਉਹਦੇ ਵਿੱਚ ਮੈਨੂੰ ਇੰਨੀ ਕੁ ਮਤਲਬ ਕਈ ਵਾਰ ਇੰਨੀ ਕੁ ਮੁਸ਼ਕਿਲ ਆਉਂਦੀ ਹੈ ਜਾਂ ਕਮੀ ਮਹਿਸੂਸ ਹੁੰਦੀ ਹੈ ਕਿ ਸਟੇਸ਼ਨਰੀ ਦਾ ਪ੍ਰੋਪਰ ਸਮਾਨ ਨਹੀਂ ਹੁੰਦਾ ਮੈਂ ਸਿਰਫ਼ ਜੋ ਇੱਕ ਪੈਨਸਿਲ ਹੁੰਦੀ ਆ ਉਹਦੇ ਨਾਲ ਹੀ ਹਰ ਇੱਕ ਤਰ੍ਹਾਂ ਦੀ ਸ਼ੇਡਿੰਗ ਕਰ ਲੈਂਦੀ ਹਾਂ ਹਰ ਇੱਕ ਤਰ੍ਹਾਂ ਦਾ ਡਰੋਇੰਗ ਦੇ ਵਿੱਚ ਇਫੈਕਟ ਜੋ ਪਾਉਣਾ ਹੁੰਦਾ ਹੈ ਉਹ ਮੈਂ ਉਹ ਇੱਕ ਪੈਨਸਿਲ ਦੇ ਨਾਲ ਹੀ ਕਰਦੀ ਹੁੰਦੀ ਹਾਂ ਅਤੇ ਸਟੇਸ਼ਨਰੀ ਦੀ ਕਮੀ ਜ਼ਰੂਰ ਹੁੰਦੀ ਹੈ ਇੱਥੇ ਕਿਉਂਕਿ ਇੱਥੇ ਜੋ ਅਸੀਂ ਪਿੰਡ ਵਿੱਚ ਜਿੱਦਾਂ ਰਹਿੰਦੇ ਹਾਂ ਤਾਂ ਇੱਥੇ ਕੁਝ ਖਾਸ ਜਿਹੜਾ ਵਾ ਸਟੇਸ਼ਨਰੀ ਦੀ ਸਪਲਾਈ ਨਹੀਂ ਹੁੰਦੀ ਇਸ ਤੋਂ ਇਲਾਵਾ ਜੋ ਸਹਾਇਤਾ ਵਜੋਂ ਮੇਰੇ ਮਤਲਬ ਕੋਈ ਵੀ ਮੇਰੀ ਮਤਲਬ ਹੈਲਪ ਨਹੀਂ ਕਰਦਾ ਮੈਂ ਆਪਣੇ ਆਪ ਹੀ ਜਿਹੜਾ ਵਾ ਉੱਥੋਂ ਇੱਕ ਤਸਵੀਰ ਜਿਹੜੀ ਆ ਜਾਂ ਫਿਰ ਕੁਝ ਵੀ ਆ ਉਹ ਬਣਾ ਲੈਂਦੀ ਹਾਂ ਠੀਕ ਹੈ ਮੈਨੂੰ ਕੋਈ ਡੀ ਹੈਲਪ ਦੇਣ ਹੈਲਪ ਵੀ ਨਹੀਂ ਮਿਲਦੀ ਹੈ ਹੈਲਪ ਦੀ ਵੀ ਕਮੀ ਆ ਪਰ ਕਿਤੇ ਨਾ ਕਿਤੇ ਜਿੰਨਾ ਕੁ ਮੈਨੂੰ ਚਾਹੀਦਾ ਉੱਨਾ ਕੁ ਮੈਂ ਆਪਣੇ ਜੋਗਾ ਕਰ ਲੈਂਦੀ ਹਾਂ ਅਤੇ ਮੈਨੂੰ ਵਧੀਆ ਲੱਗਦਾ ਹੈ